ਹੈਲੋ

ਹਾਂਜੀ ਅਸੀਂ ਜੀ ਚੱਲਦੇ ਹਾਂ ਆਈਲੈਟਸ ਪੀ ਟੀ ਈ ਟੋਫਲੀ ਠੀਕ ਹੈ ਇਹ ਆਪਣੇ ਕੋਰਸ ਜਿਹੜੇ ਹੈਗੇ ਚੱਲ ਰਹੇ ਆ ਆਈਲੈਟਸ ਦਾ ਜਿਹੜਾ ਹੈਗਾ ਬੈਚ ਆਪਣਾ ਹੁਣੇ ਰੀਸੈਂਟਲੀ ਜਿਹੜਾ ਹੈਗਾ ਜੂਨ ਦੇ ਵਿੱਚ ਸਟਾਰਟ ਹੋਣ ਵਾਲਾ ਗਾ ਤੁਸੀਂ ਕਿਹੜਾ ਕੋਰਸ ਲੈ ਆਪਣਾ ਇੱਕ ਜੂਨ ਤੋਂ ਸਟਾਰਟ ਹੋਣ ਵਾਲਾ ਜੀ ਇੱਕ ਆਲਰੇਡੀ ਚੱਲ ਰਿਹਾ ਗਾ ਮੈਮ ਕੋ ਇਹਨਾਂ ਦੇ ਵਿੱਚ ਆਪਣੇ ਜਿਵੇਂ ਆਈਲੈਟਸ ਦੇ ਕੋਰਸ ਦੇ ਆਪਾਂ ਮੰਥਲੀ ਫੀਸ ਰੱਖਦੇ ਹੈਗੇ ਆ ਤਿੰਨ ਮਹੀਨਿਆਂ ਦੇ ਵਿੱਚ ਆਪਣਾ ਜਿਹੜਾ ਹੈਗਾ ਇਹਦਾ ਸਾਰਾ ਜਿਹੜਾ ਹੈਗਾ ਕੋਰਸ ਦਾ ਆਪਣਾ ਡਨ ਹੋ ਜਾਂਦਾ ਬੈਂਡ ਵਗੈਰਾ ਸਾਰੇ ਆਪਣੇ ਆ ਜਾਂਦੇ ਆ ਸਾਡੀ ਕੋਰਸ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਤਿੰਨ ਮਹੀਨਿਆਂ ਦੇ ਵਿੱਚ ਆਪਾਂ ਸਾਰਾ ਕੁਛ ਬੈਂਡ ਲਿਆਈਏ ਹਾਂਜੀ ਤੁਸੀਂ ਇੱਕ ਵਾਰੀ ਵਿਜਿਟ ਕਰੋ ਡੈਮੋ ਕਲਾਸਿਜ ਲਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਅੱਗੇ ਵੀ ਜਿਹੜੇ ਨਾ ਆਪਣੀ ਜਿਹੜੀ ਹੈਗੀ ਹੈਗੀ ਕਲਾਸਿਸ ਕੰਟੀਨਿਊ ਕਰੋ ਡੈਮੋ ਕਲਾਸਿਸ ਦੀ ਕੋਈ ਫੀਸ ਨੀਗੀ ਉਹ ਆਪਾਂ ਫਰੀ ਆਫ ਕੋਸਟ ਕਰਵਾਵਾਂਗੇ ਤੁਹਾਨੂੰ ਆਈਲੈਟਸ ਕੋਰਸ ਵੀ ਜੇ ਤੁਸੀਂ ਆਈਲੈਟਸ ਕੋਰਸ ਕਰਦੇ ਹੋ ਤਾਂ ਤੁਹਾਡੇ ਕੋਲ ਮੰਥਲੀ ਜਿਹੜੀ ਫੀਸ ਹੈਗੀ ਆ ਤੁਹਾਨੂੰ ਪਊਗੀ ਅੱਠ ਹਜ਼ਾਰ ਜੇ ਤੁਸੀਂ ਇਕੱਠੀ ਤਿੰਨ ਮਹੀਨਿਆਂ ਦੀ ਫੀਸ ਜਿਹੜੀ ਹੈਗੀ ਹੈਗੀ ਪੇ ਕਰਦੇ ਹੋ ਤਿੰਨ ਮਹੀਨੇ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਜਿਹੜੀ ਹੈਗੀ ਹੈਗੀ ਇਹ ਵੀਹ ਹਜ਼ਾਰ ਪੈ ਜੂਗੀ ਤੁਹਾਨੂੰ ਚੋ ਚਾਰ ਹਜ਼ਾਰ ਚਾਰ ਹਜ਼ਾਰ ਜਿਹੜਾ ਹੈਗਾ ਡਿਸਕਾਊਂਟ ਦੇ ਦੇਵਾਂਗੇ ਅਤੇ ਹਾਂਜੀ ਤੁਸੀਂ ਅੱਜ ਵੀ ਵਿਜਿਟ ਕਰ ਸਕਦੇ ਹੋਗੇ ਜਿਹੜਾ ਹੈਗਾ ਆਪਣਾ ਔਫਿਸ ਪੰਜ ਵਜੇ ਤੱਕ ਖੁੱਲ੍ਹਾ ਰਹਿੰਦਾ ਹੈਗਾ ਤੁਸੀਂ ਕਦੋਂਵੀ ਵਿਜਿਟ ਕਰ ਸਕਦੇ ਹੋ ਹਾਂਜੀ ਆਪਣਾ ਬਠਿੰਡਾ ਅਜੀਤ ਰੋਡ ਓਕੇ ਅਤੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਵੇ ਤਾਂ ਤੁਸੀਂ ਬੇਸ਼ੱਕ ਇਸ ਨੰਬਰ 'ਤੇ ਕੋਲ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਹੈਲਪ ਕਰਾਂਗੇ ਅਤੇ ਤੁਹਾਡੇ ਬੈਂਡ ਜਿਹੜੇ ਹੈਗੇ ਹੈਗੇ ਵੀ ਪੱਕਾ ਜਿਹੜੇ ਹੈਗੇ ਤੁਹਾਡੇ ਆਉਣਗੇ ਪਰ ਤੁਸੀਂ ਇੱਕ ਸਾਡਾ ਸਾਥ ਦਿਓ ਅਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ